ਸਤਿ ਸ਼੍ਰੀ ਅਕਾਲ ਜੀ ਮੈਂ ਰਵੀ ਗਿਰੀ ਗੱਲ ਕਰ ਰਿਹਾਂ ਮੈਂ ਅਤੇ ਸਰ ਮੈਂ ਤੁਹਾਡੇ ਇੰਨਸਟਾਗ੍ਰਾਮ ਪੇਜ਼ ਤੋਂ ਪਹਿਲਾਂ ਦੋ ਹਫ਼ਤੇ ਪਹਿਲਾਂ ਹੀ ਜਿਵੇਂ ਇੱਕ ਲੈਪਟੋਪ ਔਡਰ ਕੀਤਾ ਸੀਗਾ ਅਤੇ ਸਰ ਤੁਹਾਡੇ ਕਹਿਣ ਦੇ ਮੁਤਾਬਿਕ ਇਹ ਮੈਂ ਲੈਪਟੋਪ ਮੈਨੂੰ ਦੋ ਹਫ਼ਤਿਆਂ 'ਚ ਔਡਰ ਹੋਣਾ ਸੀਗਾ ਠੀਕ ਹੈ ਅਤੇ ਸਰ ਇਹ ਜਿਹੜਾ ਲੈਪਟੋਪ ਹੈ ਸਰ ਤੁਹਾਡੇ ਤੁਸੀਂ ਦੋ ਹਫ਼ਤਿਆਂ 'ਚ ਕਿਹਾ ਸੀਗਾ ਬਟ ਸਰ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਇਹ ਲੈਪਟੋਪ ਹੈ ਇਹ ਮੈਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਮੈਨੂੰ ਮਿਲ ਗਿਆ ਅਤੇ ਸਰ ਇੱਕ ਹਫ਼ਤਾ ਮੈਨੂੰ ਔਲਰੇਡੀ ਇਹਨੂੰ ਚਲਾਉਂਦੇ ਵੀ ਹੋ ਗਿਆ ਹੈ ਅਤੇ ਸਰ ਜੋ ਆਪਣਾ ਜੋ ਲੈਪਟੋਪ ਹੈ ਸਰ ਇਹਦਾ ਕਲਰ ਹੀ ਮਤਲਬ ਬੜਾ ਹੀ ਪਿਆਰਾ ਏ ਅਤੇ ਸਰ ਇਹਦੀ ਜੋ ਸਪੀਡ ਹੈ ਸਰ ਚੱਲਣ ਦੀ ਬੜੀ ਇੰਨਾ ਸਮੂਦ ਚੱਲਦਾ ਹੈ ਸਰ ਹੱਦ ਨਾਲੋਂ ਵੱਧ ਅਤੇ ਇਸ 'ਚ ਸਰ ਜਿਹੜਾ ਪ੍ਰੋਸੈਸਰ ਹੈ ਮੈਨੂੰ ਇਹਦਾ ਪ੍ਰੋਸੈਸਰ ਸਰ ਬਹੁਤ ਵਧੀਆ ਲੱਗਾ ਬਿਲਕੁੱਲ ਸਰ ਹੈਂਗ ਵਗੈਰਾ ਨਹੀਂ ਹੁੰਦਾ ਅਤੇ ਸਰ ਜਿਵੇਂ ਆਮ ਅੱਜ ਕੱਲ੍ਹ ਲੈਪਟੋਪ ਵਗੈਰਾ ਚੱਲਦੇ ਚੱਲਦੇ ਹੀਟ ਮਾਰ ਜਾਂਦੇ ਨੇ ਅਤੇ ਉਹ ਗਰਮ ਹੁੰਦੇ ਨੇ ਬਹੁਤ ਜ਼ਿਆਦਾ ਇਸ 'ਚ ਸਰ ਇੱਦਾਂ ਦੀ ਕੋਈ ਵੀ ਦਿੱਕਤ ਨਹੀਂ ਹੈ ਅਤੇ ਸਰ ਇਹਦਾ ਜਿਹੜਾ ਕੀਬੋਰਡ ਹੈ ਅਤੇ ਸਰ ਮਾਊਸ ਹੈ ਉਹਦੀ ਸਰ ਇੰਨੀ ਕ ਜ਼ਿਆਦਾ ਸਰ ਉਹਦਾ ਕੀਬੋਰਡ ਸਮੂਦ ਚੱਲਦਾ ਹੈ ਮਤਲਬ ਹੱਦ ਤੋਂ ਵੱਧ ਸਰ ਅਤੇ ਸਰ ਜਿਵੇਂ ਸਰ ਇਹਦਾ ਮਤਲਬ ਵੇਟ ਦੀ ਗੱਲ ਕਰੀਏ ਜਿਵੇਂ ਆਮ ਤੌਰ 'ਤੇ ਸਰ ਇੱਡੇ ਭਾਰੇ ਭਾਰੇ ਲੈਪਟੋਪ ਹੁੰਦੇ ਹੈ ਜਿਵੇਂ ਆਪਾਂ ਨੂੰ ਚੱਕਣ 'ਚ ਵੀ ਦਿੱਕਤ ਹੁੰਦੀ ਹੈ ਇਧਰੋਂ ਉੱਧਰ ਇਧਰੋਂ ਉੱਧਰ ਸਰ ਇਹਦਾ ਜਿਹੜਾ ਵੇਟ ਹੈ ਸਰ ਉਹ ਤਾਂ ਬਿਲਕੁੱਲ ਹੀ ਲਾਈਟ ਵੇਟ ਹੈ ਅਤੇ ਸਰ ਗੱਲ ਕਰੀਏ ਸਰ ਇਹਦੇ ਚੱਲਣ ਦੀ ਅਤੇ ਸਰ ਇਹਦੀ ਜਿਹੜਾ ਬੈਟਰੀ ਬੈਕਅੱਪ ਹੈ ਸਰ ਬੈਟਰੀ ਬੈਕਅੱਪ ਸਰ ਬਹੁਤ ਅੱਛਾ ਇਹਦਾ ਅਤੇ ਸਰ ਜਿਹੜਾ ਤੁਹਾਡਾ ਪ੍ਰੋਡਕਟ ਹੈ ਸਰ ਮੈਂ ਬਹੁਤ ਖੁਸ਼ ਹਾਂ ਸਰ ਥੈਂਕ ਯੂ ਸਰ